ਅਸੀਂ ਪੰਜਾਬ ਰਾਜ ਦੀ ਸਟੀਟ ਤੋਂ ਪਰਮ ਬਲੋਂਗ ਕਰਦੇ ਹਾਂ ਜਿੱਥੋਂ ਤੱਕ ਕਬੀਲਿਆਂ ਦਾ ਸਵਾਲ ਹੈ ਸਾਡੇ ਪੰਜਾਬ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਬੀਲਾ ਨਹੀਂ ਪਾਇਆ ਜਾਂਦਾ ਸ਼ਡਿਊਲ ਟਰਾਇਬ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਸਾਡੇ ਪੰਜਾਬ ਦੇ ਵਿੱਚ ਜੀਰੋ ਹੈ ਪਰ ਇੱਕ ਗੱਲ ਹੈ ਵੀ ਜਿੱਦਾਂ ਜਿਹਨੂੰ ਆਪਾਂ ਬੰਗਾਲੇ ਕਹਿੰਦੇ ਗੱਡੀਆਂ ਵਾਲੇ ਕਹਿੰਦੇ ਵੱਖ ਵੱਖ ਜਿਹੜੇ ਕਬੀਲੇ ਹੈ ਜਾਤੀਆਂ ਸ਼੍ਰੇਣੀਆਂ ਦੇ ਲੋਕ ਹੈ ਜਿਹੜੇ ਪੰਜਾਬ ਦੇ ਵਿੱਚ ਪਾਏ ਜਾਂਦੇ ਉਹਨਾਂ ਦਾ ਮੁੱਖ ਕਿੱਤਾ ਜਿੱਦਾਂ ਗੱਡੀਆਂ ਵਾਲਿਆਂ ਦੀ ਗੱਲ ਕਰ ਲਈਏ ਉਹਨਾਂ ਦਾ ਮੁੱਖ ਕਿੱਤਾ ਜਿਹੜਾ ਚੱਲਦਾ ਆਉਂਦਾ ਪਰੰਪਰਾਗਤ ਜਿਹੜਾ ਤਰੀਕਾ ਹੈ ਉਹਨਾਂ ਦਾ ਕਬੀਲਿਆਂ ਦਾ ਉਹ ਹੈਗਾ ਪਿੰਡਾਂ ਦੇ ਵਿੱਚ ਜਾ ਕੇ ਲੋਹੇ ਦਾ ਸਮਾਨ ਬਣਾ ਕੇ ਦੇਣਾ ਚੁੱਲ੍ਹੇ ਤਵੇ ਪੀਪੇ ਉਹਦੇ ਤੋਂ ਉਲਟ ਚਿਮਟੇ ਭਾਂਡਿਆਂ ਦਾ ਸਮਾਨ ਹੋਰ ਕਲੀਆਂ ਦਾ ਸਮਾਨ ਜਿਹੜਾ ਬਣਾ ਕੇ ਕਰਨ ਦਾ ਕੰਮ ਕਰਦੇ ਪਰ ਉਹ ਲੋਕ ਕੋਈ ਟਿਕਾਊ ਜੀਵਨ ਨਹੀਂ ਬਤੀਤ ਕਰਦੇ ਉਹ ਆਪਣੇ ਕਿੱਤੇ ਦੇ ਹਿਸਾਬ ਦੇ ਨਾਲ ਆਪਣਾ ਜਿਹੜਾ ਜੀਵਨ ਹੈ ਉਹਨੂੰ ਬਦਲਦੇ ਬਦਲ ਕੇ ਅੱਜ ਉਹ ਇਸ ਪਿੰਡ ਵਿੱਚ ਕੱਲ੍ਹ ਨੂੰ ਉਸ ਪਿੰਡ ਦੇ ਵਿੱਚ ਜਾ ਕੇ ਆਪਣਾ ਜਿਹੜਾ ਗੱਡੀਆਂ ਨੂੰ ਲਗਾ ਕੇ ਰੇਹੜੀਆਂ ਲਗਾ ਕੇ ਆਪਣੇ ਝੁੱਗੀਆਂ ਝੌਂਪੜੀਆਂ ਰਹਿ ਕੇ ਗੁਜ਼ਾਰਾ ਪੇਸ਼ ਕਰਦੇ ਜਿੱਥੋਂ ਤੱਕ ਉਹਨਾਂ ਦੇ ਕਿੱਤਿਆਂ ਦੇ ਵਿੱਚ ਆਈ ਤਬਦੀਲੀ ਦਾ ਸਵਾਲ ਹੈ ਅੱਜ ਉਹਨਾਂ ਦੇ ਕਿੱਤਿਆਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਚੁੱਕੀ ਹੈ ਤਬਦੀਲੀ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਲਈਏ ਅੱਜ ਉਹਨਾਂ ਦਾ ਕੰਮ ਜਿਹੜਾ ਸਥਾਈ ਨਹੀਂ ਰਹਿ ਗਿਆ ਕਿਉਂਕਿ ਸਾਰਾ ਕੰਮ ਟਕਨੋਲੋਜੀ ਦੇ ਉੱਪਰ ਨਿਰਭਰ ਹੋ ਗਿਆ ਟਕਨੋਲੋਜੀ ਦੇ ਉੱਪਰ ਕੰਮ ਨਿਰਭਰ ਹੋਣ ਦੇ ਕਾਰਨ ਕਿਆ ਹੋਇਆ ਸੰਗਤਾਂ ਨੁੂੰ ਬੜੀਆਂ ਦੁਖਤਾਂ ਦੁੱਖਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਕਿਆ ਜਿਵੇਂ ਕਿਆ ਉਹਨਾਂ ਦੇ ਜਿਹੜੇ ਭਾਂਡੇ ਠਿੰਡੇ ਤਵੇ ਚਿਮਟੇ ਖੁਰਪੀਆਂ ਖੁਰਪੇ ਪਤੀਲੇ ਪੀਪੇ ਇਹ ਸਾਰਾ ਕੰਮ ਜਿਹੜਾ ਬੰਦ ਹੋ ਚੁੱਕਿਆ ਬੰਦ ਹੋਣ ਦੇ ਵਿੱਚ ਮੁੱਖ ਇਹ ਰਾਜ ਹੈ ਕਿ ਅੱਜ ਸਾਰਾ ਕੰਮ ਮਸ਼ੀਨਰੀ ਦੇ ਹੋਣ ਦੇ ਨਾਲ ਅੱਜ ਸਾਰਾ ਕੰਮ ਮਸ਼ੀਨਰੀ ਦਾ ਯੁੱਗ ਹੋਣ ਦੇ ਨਾਲ ਉਹਨਾਂ ਦਾ ਜਿਹੜਾ ਹੱਥੀਂ ਬਣਾਇਆ ਕੰਮ ਹੈ ਉਹ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਜਿਹੜਾ ਕੰਮ ਉਹ ਪੱਚੀ ਤੀਹ ਪੰਜਾਹ ਸੌ ਡੇਢ ਸੌ ਵਿੱਚ ਕਰਦੇ ਉਹ ਹੀ ਕੰਮ ਮਸ਼ੀਨ ਹੈ ਜਿਹੜਾ ਦਸ ਰੁਪਈਏ ਦੇ ਵਿੱਚ ਸਾਨੂੰ ਕਰਕੇ ਰੱਖ ਦਿੰਦੀ ਸੋ ਕਿੱਤਿਆਂ ਦੇ ਵਿੱਚ ਕਬੀਲਿਆਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਜਿਹੜੀ ਆ ਚੁੱਕੀ ਹੈ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਕਿ ਭੈਣੇ ਬਸ ਬਸ ਕਰੋ ਇੰਨਾ ਕਹਿਰ ਨਾ ਕਰੋ ਇੰਨਾ ਕਹਿਰ ਕਰਨ ਦਾ ਕੋਈ ਮਤਲਬ ਨਹੀਂ ਧੰਨਵਾਦ